ਹਾਂਜੀ ਭਾਰਤ ਵਿੱਚ ਸਭ ਨੂੰ ਚਾਹ ਬਹੁਤ ਪਸੰਦ ਹੈ ਸਵੇਰੇ ਉੱਠਦਿਆਂ ਸਾਰ ਹੀ ਚਾਹ ਦੇ ਨਾਲ ਹੀ ਸ਼ੁਰੂਆਤ ਹੁੰਦੀ ਹੈ ਸਾਰੇ ਕੰਮਾਂ ਦੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਚਾਹ ਬਣਾ ਕੇ ਪੀਤੀ ਜਾਂਦੀ ਹੈ ਜਦੋਂ ਕੋਈ ਘਰ 'ਚ ਮ ਮਹਿਮਾਨ ਆਉਂਦਾ ਹੈ ਉਦੋਂ ਵੀ ਪਹਿਲਾਂ ਚਾਹ ਹੀ ਬਣਾ ਕੇ ਪਿਆਈ ਜਾਂਦੀ ਹੈ ਤੇ ਕਈ ਚਾਹ ਜਿਹੜੀ ਆ ਉਹ ਉਹਨੂੰ ਅਗਲਾ ਵੱਖ ਵੱਖ ਤਰੀਕਿਆਂ ਨਾਲ ਬਣਾਉਂਦੇ ਆ ਕਈ ਘੱਟ ਮਿੱਠਾ ਕਈ ਲੂਣ ਵਿੱਚ ਮਿਕਸ ਕਰ ਕੇ ਚਾਹ ਬਣਾਉਂਦੇ ਆ ਪੀਂਦੇ ਆ ਜਿਸ ਤਰ੍ਹਾਂ ਸ਼ੂਗਰ ਗੁੜ ਦੀ ਚਾਹ ਵੀ ਬਣਾਈ ਜਾਂਦੀ ਆ ਅਤੇ ਉਹ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ ਹਾਂਜੀ ਅਤੇ ਅੱਜ ਕੱਲ੍ਹ ਜਿਸ ਤਰ੍ਹਾਂ ਚਾਹ ਦੇ ਵਿੱਚ ਮਿੱਠਾ ਬਹੁਤ ਘੱਟ ਹੀ ਪਸੰਦ ਕਰਦੇ ਲੋਕ ਅਤੇ ਇਸ ਤਰ੍ਹਾਂ ਵੀ ਚਾਹ ਜਿਸ ਤਰ੍ਹਾਂ ਦੀ ਕਿਸੇ ਨੇ ਪੀਣੀ ਹੁੰਦੀ ਹੈ ਚਾਹ ਬਣਾਈ ਜਾਂਦੀ ਹੈ ਚਾਹ ਹੀ ਜਿਹੜੇ ਭਾਰਤ 'ਚ ਉਹ ਸਭ ਦੀ ਪਹਿਲੀ ਪਸੰਦ ਚਾਹ ਹੀ ਜਦੋਂ ਥਕਾਵਟ ਹੁੰਦੀ ਆ ਉਦੋਂ ਵੀ ਘਰਾਂ ਚਾਹ ਬਣਾ ਕੇ ਪੀਤੀ ਜਾਂਦੀ ਹੈ ਜੀਹਦੇ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਸਿਰ ਦਰਦ ਹੋ ਰਿਹਾ ਹੋਵੇ ਤਾਂ ਵੀ ਚਾਹ ਬਣਾਉਣੀ ਹੁੰਦੀ ਆ ਚਾਹ ਬਣਾ ਕੇ ਪੀ ਕੇ ਰੈਸਟ ਕਰ ਲਓ ਹਾਂਜੀ ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਅਸੀਂ ਜਿਹੜੀ ਆਪਣੀ ਘਰ 'ਚ ਚਾਹ ਬਣਾਉਂਦੇ ਹਾਂ ਉਹ ਬਣਾਉਂਦੇ ਹੈਗੇ ਹਾਂ ਪਹਿਲਾਂ ਪਾਣੀ ਨੂੰ ਗਰਮ ਕਰ ਕੇ ਉਸ ਵਿੱਚ ਖੰਡ ਮਿੱਠਾ ਥੋੜ੍ਹਾ ਜਿਹਾ ਲੂਣ ਵਿੱਚ ਉਹਦੇ ਚਾਹ ਪੱਤੀ ਮਿਕਸ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਉਬਾਲਾ ਦਿਵਾਇਆ ਜਾਂਦਾ ਵਿੱਚ ਦੁੱਧ ਪਾ ਕੇ ਜੋ ਵੀ ਆਪਾਂ ਜੇ ਮਸਾਲੇਦਾਰ ਚਾਹ ਵਧੀਆ ਹੋਰ ਟੇਸਟੀ ਬਣਾਉਣੀ ਆ ਤਾਂ ਹਰੀ ਇਲਾਇਚੀ ਮੋਟੀ ਇਲਾਇਚੀ ਅਤੇ ਮਗਹਾਂ ਹੋਰ ਇਸ ਤਰ੍ਹਾਂ ਅਜਵਾਇਣ ਵਗੈਰਾ ਐਡ ਕਰ ਸਕਦੇ ਹਾਂ ਉਹਦੇ ਵਿੱਚ ਮਿਕਸ ਕਰ ਸਕਦੇ ਜਿਸ ਨਾਲ ਚਾਹ ਦਾ ਸੁਆਦ ਹੋਰ ਵੀ ਜ਼ਿਆਦਾ ਵਧੀਆ ਬਣਦਾ ਹੈ ਹਾਂਜੀ